ਹਾਂਜੀ ਬੋਲ ਰਿਹਾ ਸਰ ਤੁਸੀਂ ਸਰ ਮੈਨੂੰ ਮੈਂ ਪੰਜਾਬੀ ਟ੍ਰਿਬਿਊਨ ਅਖ਼ਬਾਰ 'ਚ ਕੰਮ ਕਰਦਾ ਮੈਂ ਪੱਤਰਕਾਰ ਹਾਂ ਜੀ ਅਤੇ ਤੁਸੀਂ ਥਾਣੇ 'ਚੋਂ ਬੋਲ ਰਹੇ ਹੋ ਮੋਰਿੰਡਾ ਚੌਂਕੀ ਤੋਂ ਅੱਛਾ ਸਰ ਮੈਂ ਪੁੱਛਣਾ ਸੀਗਾ ਤੁਹਾਨੂੰ ਵੀ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਨੌਜਵਾਨ ਪੀੜ੍ਹੀ ਛੋਟੇ ਛੋਟੇ ਨਸ਼ਾ ਕਰਨ ਲੱਗ ਗਏ ਚਿੱਟੇ ਦੇ ਉੱਪਰ ਹੈ ਨਾ ਤਾਂ ਕਹਿਣ ਦਾ ਮਤਲਬ ਇਹ ਇਸ 'ਤੇ ਅ ਤੁਸੀਂ ਕੀ ਰਸਤੇ ਨੂੰ ਰੋਕਣ ਵਾਸਤੇ ਕਿਉਂਕਿ ਇਹ ਦਿਨੋ ਦਿਨ ਵਧ ਰਿਹਾ ਹੈਗਾ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈਗਾ ਇਹਦੇ ਵਾਸਤੇ ਪੁਲਿਸ ਕੀ ਕਰ ਰਹੀ ਹੈ ਹੈਲੋ ਹੈਲੋ ਹੈਲੋ ਹਾਂਜੀ ਹਾਂਜੀ ਦੱਸੋ ਦੱਸੋ ਦੱਸੋ ਦੱਸੋ ਦੱਸੋ ਤੁਸੀਂ

ਅੱਛਾ ਨਹੀਂ ਜੀ ਪੁਲਸ ਪੁਲਸ ਦੇਖੋ ਜੀ ਦੇਖੋ ਇਹ ਗੱਲ ਇੱਦਾਂ ਵੀ ਹੈ ਨਾ ਵੀ ਜਿਹੜੀ ਇਹ ਰਾਜਨੀਤੀ ਚਲਾ ਰਹੇ ਆ ਇਹਨੂੰ ਪੰਜਾਬ ਦੀ ਹਕੀਕਤ ਆ ਜੋ ਉਹ ਪੁਲਿਸ ਵੀ ਦੱਸ ਸਕਦੀ ਹੈ ਨਾ ਕਹਿਣ ਦਾ ਮਤਲਬ ਰਾਜਨੀਤੀ ਦੇ ਵਿੱਚ ਜੋ ਬੰਦੇ ਆਪਣੇ ਮੰਤਰੀ ਹੋ ਗਏ ਜਾਂ ਵੱਡੇ ਅਹੁਦਿਆਂ 'ਤੇ ਜੋ ਅਫ਼ਸਰ ਬੈਠੇ ਆ ਹੈ ਨਾ ਵੀ ਥੱਲੜੇ ਲੇਵਲ ਦਾ ਤਾਂ ਯਾਨੀ ਕਿ ਇਹ ਤੁਸੀਂ ਦੱਸ ਸਕਦੇ ਹੋ ਨਾ ਹਾਂਜੀ

ਅੱਛਾ ਜੀ ਅੱਛਾ ਜੀ ਨਹੀਂ ਇਹ ਤਾਂ ਕਮਜ਼ੋਰੀ ਇਹ ਤਾਂ ਕਮਜ਼ੋਰੀ ਹੈਗੀ ਹੈ ਇੱਕ ਦੇਖੋ ਪਰ ਇਹ ਚੀਜ਼ ਇਹ ਚੀਜ਼ ਸਹੀ ਹੈ ਮੈਂ ਛੋਟੇ ਛੋਟੇ ਛੋਟੇ ਤੇ ਜੇ ਦੇਖੀ ਜਾਵੇ ਤਾਂ ਬਹੁਤ ਮੰਦਭਾਗੀ ਹੋਊਗੀ ਕਹਿਣ ਦਾ ਮਤਲਬ ਦੇਸ਼ ਅਤੇ ਪੁਲਸ ਨੂੰ ਵੀ ਕੁਛ ਨਾ ਕੁਛ ਕਰਨਾ ਹੀ ਚਾਹੀਦਾ ਗਾ ਚਾਹੇ ਚਾਹੇ ਅਤੇ ਤੁਹਾਨੂੰ ਕੁਛ ਕਾਰਵਾਈ ਠੀਕ ਹੈ ਹੁਣ ਤੱਕ ਪੰਜਾਬ ਦੇ ਵਿੱਚ ਕਿੰਨੇ ਕੇਸ ਫੜੇ ਗਏ ਅੱਛਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ